ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਹਰ ਰੋਜ਼ ਅਨੇਕਾਂ ਹੀ ਘਟਨਾਵਾਂ ਹੁੰਦੀਆਂ ਨੇ ਅਤੇ ਰੋਜ਼ ਨਵੀਂ ਨ ਕੋਈ ਨਾ ਨਵੀਂ ਅਤੇ ਨਵੀਂ ਖ਼ਬਰ ਆਉਂਦੀ ਹੈ ਹਰ ਦਿਨ ਕੋਈ ਨਾ ਅਜੀਬ ਜਿਹੀ ਖ਼ਬਰ ਸੁਣਨ ਨੂੰ ਮਿਲਦੀ ਹੈ ਜਿਹੜੀ ਕਿ ਦਿਲਚਸਪ ਤਾਂ ਹੁੰਦੀ ਹੀ ਹੈ ਨਾਲ ਕੀ ਹੈਰਾਨੀ ਵੀ ਪੀ ਹੁੰਦੀ ਹੈ ਐਵੇਂ ਹੀ ਅੱਜ ਇੱਕ ਮੈਂ ਨਵੀਂ ਖ਼ਬਰ ਸੁਣੀ ਜਿਹੜੀ ਕਿ ਮੈਨੂੰ ਬੜੀ ਹੀ ਅਲੱਗ ਕਿਸਮ ਦੀ ਲੱਗੀ ਉਹ ਸੀ ਕਿ ਹਰਿਮੰਦਰ ਸਾਹਿਬ ਦੀ ਗੋਲਕ 'ਚੋਂ ਇਕ ਲੱਖ ਰੁਪਏ ਚੋਰੀ ਹੋ ਗਏ ਹਰਿਮੰਦਰ ਸਾਹਿਬ ਸਿੱਖ ਅ ਜਿਥ ਗੋਲਡਨ ਟੈਂਪਲ ਜਿੱਥੇ ਹਜ਼ਾਰਾਂ ਲੋਕ ਦੇਸ਼ ਵਿਦੇਸ਼ਾਂ ਵਿੱਚੋਂ ਮੱਥਾ ਟੇਕਣ ਆਉਂਦੇ ਹਨ ਅਤੇ ਕਦੇ ਵੀ ਆਪਾਂ ਹਰਿਮੰਦਰ ਸਾਹਿਬ 'ਚ ਇਹ ਗੱਲ ਨਹੀਂ ਸੁਣੀ ਕਿ ਉੱਥੇ ਕਦੇ ਚੋਰੀ ਹੋ ਜਾਵੇ ਪਰ ਅੱਜ ਖ਼ਬਰ ਆ ਰਹੀ ਹੈ ਕਿ ਹਰਿਮੰਦਰ ਸਾਹਿਬ ਦੀ ਗੋਲਕ 'ਚੋਂ ਇੱਕ ਲੱਖ ਰੁਪਇਆ ਚੋਰੀ ਹੋ ਗਿਆ ਗੋਲਕ 'ਚੋਂ ਪੰਜਾਹ ਪੰਜਾਹ ਹਜ਼ਾਰ ਦੇ ਦੋ ਬੰਡਲ ਚੋਰੀ ਹੋਏ ਇਹ ਚੋਰੀ ਇੱਕ ਮਹਿਲਾ ਅਤੇ ਉਸਦੇ ਦੋ ਸਾਥੀਆਂ ਨੇ ਕੀਤੀ ਅਤੇ ਕਰ ਕੇ ਉਹ ਭੱਜ ਗਏ ਉਹਨਾਂ ਨੇ ਕੀ ਕੀਤਾ ਕਿ ਉਹਨਾਂ ਨੇ ਅਰਦਾਸ ਕਰਾਉਣ ਲੱਗੇ ਅਰਦਾਸ ਕਰਾਉਣ ਲਈ ਉਹਨਾਂ ਨੇ ਪਰਚੀ ਕਟਾਈ ਪਰਚੀ ਕਟਾਉਣ ਦੇ ਭੁਲੇਖੇ ਉਹਨਾਂ ਨੇ ਕੁਛ ਗੇਰ ਦਿੱਤਾ ਜਿਸ ਨਾਲ ਉੱਥੇ ਦਾ ਜਿਹੜਾ ਪਰਚੀ ਕੱਟਦੇ ਸਨ ਉਹਨਾਂ ਨੂੰ ਭੁਲੇਖਾ ਪੈ ਗਿਆ ਉਹ ਨੀਚੇ ਚੱਕਣ ਲਈ ਹੋਏ ਤਾਂ ਇੰਨੇ ਨੂੰ ਉਹਨਾਂ ਨੇ ਉਹਦੇ 'ਚੋਂ ਗੋਲਕ 'ਚੋਂ ਪੰਜਾਹ ਪੰਜਾਹ ਹਜ਼ਾਰ ਦੀਆਂ ਦੋ ਗੱਠੀਆਂ ਕੱਢ ਲਈਆਂ ਇਹ ਪੰਜਾਹ ਪੰਜਾਹ ਹਜ਼ਾਰ ਰੁਪਏ ਏ ਦਾ ਮਤਲਬ ਉਹਨਾਂ ਨੇ ਇੱਕ ਲੱਖ ਰੁਪਿਆ ਚੋਰੀ ਕਰ ਲਿਆ ਹੁਣ ਇਸ ਖ਼ਬਰ ਨੂੰ ਦਾ ਖ਼ਬਰ ਕਿੰਨੀ ਅਜੀਬ ਹੈ ਕਿ ਹਰਿਮੰਦਰ ਸਾਹਿਬ 'ਚੋਂ ਵੀ ਲੋਕ ਚੋਰੀ ਕਰਨ ਲੱਗ ਗਏ ਕਿੰਨੇ ਲੋਕ ਉਹ ਹੋ ਗਏ ਕਿ ਜਿੱਥੇ ਆਪਾਂ ਮੱਥਾ ਟੇਕਣ ਜਾਂਦੇ ਹਾਂ ਉੱਥੇ ਵੀ ਲੋਕ ਚੋਰੀ ਕਰਨ ਲੱਗ ਗਏ ਅੱਜ ਕੱਲ੍ਹ ਚੋਰਾਂ ਦਾ ਵੀ ਨਹੀਂ ਪਤਾ ਲੱਗਦਾ ਉਹ ਕਿਸ ਤਰ੍ਹਾਂ ਦੀਆਂ ਚੋਰੀਆਂ ਕਰਦੇ ਹਨ ਹਾਲਾਂਕਿ ਇਹਦੀ ਸੀ ਸੀ ਟੀ ਵੀ ਕੈਮਰੇ ਰਾਹੀਂ ਭਾਲ ਤਾ ਕੀਤੀ ਜਾ ਰਹੀ ਹੈ ਪਰ ਐਸ ਜੀ ਪੀ ਸੀ ਨੇ ਵੀ ਇਹਦਾ ਬੜਾ ਵਿਰੋਧ ਕੀਤਾ ਹੈ ਉਹ ਕਿ ਉਹਨਾਂ ਨੇ ਵੀ ਆਪਣੇ ਵੱਲੋਂ ਇਹਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਕਿ ਇਹ ਕਿਵੇਂ ਹੋ ਸਕਦਾ ਹੈ ਕਿ ਕੋਈ ਆ ਕੇ ਗੋ ਗੋਲਡਨ ਟੈਂਪਲ ਵਿੱਚੋਂ ਵੀ ਚੋਰੀ ਕਰ ਲਵੇ